ਅੰਤਰ ਭਾਈਚਾਰਕ ਜਿਹੜੀ ਸਾਂਝ ਹੈ ਸਿੱਖਾਂ ਦੀ ਬੜੀ ਹਿੰਦੂਆਂ ਨਾਲ ਵੱਡੀ ਸਾਂਝ ਹੈ ਕਿਉਂਕਿ ਜਿਹੜੇ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਅਤੇ ਜਦੋਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋ ਜਨੇਊ ਦੀ ਰੱਖਿਆ ਲਈ ਪੁੱਜੇ ਤਾਂ ਉਹਨਾਂ ਨੇ ਔਰੰਗਜ਼ੇਬ ਦੇ ਜੁਰਮਾਂ ਦੀ ਦਾਸਤਾਨ ਸੁਣਾਈ ਤਾਂ ਗੁਰੂ ਗੋਬਿੰਦ ਗੁਰੂ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਕੀਤੀ ਅਤੇ ਹਿੰਦੂ ਧਰਮ ਵਿੱਚ ਜਿਹੜਾ ਫਿਰ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਸਨਮਾਨ ਵੀ ਬਹੁਤ ਹੈ ਪਹਿਲਾਂ ਜਿਹੜੇ ਸੀਗੇ ਹਿੰਦੂ ਧਰਮ ਵਿੱਚ ਲੋਕ ਉਹ ਆਪਣੇ ਵੱਡੇ ਬੇਟੇ ਨੂੰ ਸਿੱਖ ਰੱਖਦੇ ਸੀਗੇ ਜੋ ਅੱਜ ਕੱਲ੍ਹ ਥੋੜ੍ਹਾ ਬਦਲ ਗਿਆ ਉਸ ਤੋਂ ਬਾਅਦ ਦਸਵੇਂ ਗੁਰੂ ਸਾਹਿਬਾਨ ਨੇ ਉਹਨਾਂ ਦੇ ਪੂਰਨਿਆਂ 'ਤੇ ਚੱਲਦੇ ਹੋਏ ਜੋਰ ਜਦੋਂ ਵਿਰੁੱਧ ਕਈ ਜੰਗਾਂ ਲੜੀਆਂ ਜਿਹਨਾਂ ਵਿੱਚ ਉਹਨਾਂ ਦੇ ਜਿਹੜੇ ਬੇਟੇ ਸੀਗੇ ਚਾਰ ਸਾਹਿਬਜ਼ਾਦੇ ਬਾਬਾ ਬਾਬਾ ਅਜੀਤ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਵੀ ਹੋਏ ਸ਼ਹੀਦੀਆਂ ਦੀ ਪ੍ਰਾਪਤ ਕੀਤੀਆਂ ਇਹ ਬਹੁਤ ਵੱਡਾ ਇਤਿਹਾਸ ਆ ਮਤਲਬ ਅਸੀਂ ਇਹ ਤੋਂ ਇਹੀ ਅਨੁਭਵ ਕਰਦੇ ਐਂ ਵੀ ਸੱਚ ਦੇ ਰਸਤੇ 'ਤੇ ਜਿਹੜੀ ਕੁਰਬਾਨੀ ਵੀ ਕਰਨੀ ਪੈਂਦੀ ਹੈ ਅਤੇ ਸੱਚ ਦਾ ਰਸਤਾ ਕਠਿਨ ਵੀ ਹੈ ਪਰ ਸੱਚ ਦੇ ਰਸਤੇ 'ਤੇ ਚੱਲ ਕੇ ਬੰਦਾ ਜੋ ਸ਼ਹੀਦੀ ਪ੍ਰਾਪਤ ਕਰਦਾ ਉਹ ਸਦਾ ਲਈ ਅਮਰ ਰਹਿੰਦਾ